ਵੈਸੇ ਤਾਂ ਭਾਰਤ ਵਿੱਚ ਬਹੁਤ ਸਾਰੀਆਂ ਘੁੰਮਣ ਦੀਆਂ ਜਗ੍ਹਾਵਾਂ ਹਨ ਲੇਕਿਨ ਸਾਨੂੰ ਤੀਰਥ ਚਾਰ ਧਾਮ ਦੀ ਯਾਤਰਾ ਜ਼ਰੂਰ ਕਰਨੀ ਚਾਹੀਦੀ ਹੈ ਇਹ ਚਾਰਾ ਧਾਮਾਂ ਦੀ ਯਾਤਰਾ ਕਰਨ ਤੋਂ ਇਲਾਵਾ ਸਾਨੂੰ ਕਈ ਹੋਰ ਤੀਰਥ ਨੇ ਜਿੱਥੇ ਸਾਨੂੰ ਜ਼ਰੂਰ ਜਾਣਾ ਚਾਹੀਦਾ ਜਿਵੇਂ ਆਯੋਧਿਆ ਮਥੁਰਾ ਵਰਿੰਦਾਵਨ ਅਤੇ ਸਾਡੇ ਇੱਕ ਅੰਮ੍ਰਿਤਸਰ ਵਿੱਚ ਗੋਲਡਨ ਟੈਂਪਲ ਨਾਮ ਦੀ ਇੱਕ ਗੁਰਦੁਆਰਾ ਹੈ ਜਿੱਥੇ ਸਾਨੂੰ ਜ਼ਰੂਰ ਆ ਕੇ ਮੱਥਾ ਟੇਕਣਾ ਚਾਹੀਦਾ ਹੈ ਇਸ ਤੋਂ ਇਲਾਵਾ ਸਾਨੂੰ ਆਪਣੀ ਇਤਿਹਾਸਿਕ ਜਗ੍ਹਾਵਾਂ 'ਤੇ ਵੀ ਜ਼ਰੂਰ ਜਾਣਾ ਚਾਹੀਦਾ ਹੈ ਜਿੱਥੇ ਸਾਡੇ ਇਤਿਹਾਸਕਾਰ ਜਿੱਥੇ ਸਾਡੇ ਕ੍ਰਾਂਤੀਕਾਰੀ ਲੋਕਾਂ ਨੇ ਜਨਮ ਲਿਆ ਅਤੇ ਜਿੱਥੇ ਉਹਨਾਂ ਨੇ ਆਖਰੀ ਸਾਹ ਲਿਆ ਸਾਨੂੰ ਜਿਵੇਂ ਸ਼ਹੀਦ ਭਗਤ ਸਿੰਘ ਦੀ ਜਨਮ ਭੂਮੀ ਖਟਕੜ ਕਲਾਂ ਜ਼ਰੂਰ ਜਾਣਾ ਚਾਹੀਦਾ ਹੈ ਅਤੇ ਉੱਥੇ ਜਾ ਕੇ ਉ ਉਹਨਾਂ ਦਾ ਮਿਊਜ਼ਅਮ ਬਣਿਆ ਹੈ ਜੋ ਉੱਥੇ ਜਾ ਕੇ ਉਹਨਾਂ ਦੇ ਜ਼ਿੰਦਗੀ ਨੂੰ ਦੇਖਣਾ ਚਾਹੀਦਾ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਕਿਵੇਂ ਕੱਟੀ ਅਤੇ ਸਾਨੂੰ ਹੁਣ ਉਸ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਇਸ ਤੋਂ ਇਲਾਵਾ ਸਾਨੂੰ ਹੋਰ ਵੀ ਦਰਸ਼ਨੀ ਸਥਾਨ ਨੇ ਜਿਵੇਂ ਤਾਜ ਮਹਿਲ ਹੋ ਗਿਆ ਲਾਲ ਕਿਲਾ ਹੋ ਗਿਆ ਕੁਤਬਮੀਨਾਰ ਇਹਨਾਂ ਚੀਜ਼ਾਂ ਨੂੰ ਵੀ ਜ਼ਰੂਰ ਦੇਖਣਾ ਚਾਹੀਦਾ ਇਹਨਾਂ ਚੀਜ਼ਾਂ ਨੂੰ ਦੇਖ ਕੇ ਸਾਨੂੰ ਪਤਾ ਲੱਗਦਾ ਹੈ ਕਿ ਸਾਡਾ ਇਤਿਹਾਸ ਕਿਵੇਂ ਦਾ ਸੀ ਅਤੇ ਅਸੀਂ ਆਪਾਂ ਕਿਵੇਂ ਆਪਾਂ ਇਤਿਹਾਸ ਨੂੰ ਆਪਾਂ ਅੱਜ ਦੇਖਦੇ ਹਾਂ ਅਤੇ ਇਹਨਾਂ ਥਾਵਾਂ ਨੂੰ ਦੇਖਣ ਤੋਂ ਬਾਅਦ ਸਾਨੂੰ ਹਰ ਜ਼ ਗੁਰਦੁਆਰੇ ਮੰਦਰ ਜਿੱਥੇ ਵੀ ਸਾਡੀ ਸ਼ਰਧਾ ਹੁੰਦੀ ਹੈ ਉਹ ਉਹ ਇਤਿਹਾਸਿਕ ਸਥਾਨ ਉੱਥੇ ਵੀ ਜ਼ਰੂਰ ਜਾਣਾ ਚਾਹੀਦਾ